ਹਰੇਕ ਧਾਰਮਿਕ ਸਥਾਨ ਦੇ ਆਪਣੇ ਆਪਣੇ ਸੱਭਿਆਚਾਰਕ ਮੇਲੇ ਹੁੰਦੇ ਹੈ ਅਲੱਗ ਅਲੱਗ ਕਲਾਕਾਰ ਆ ਕੇ ਅਲੱਗ ਅਲੱਗ ਤਰੀਕੇ ਨਾਲ ਆਪਣੀ ਪ੍ਰਭੂ ਦੀ ਬੰਦਗੀ ਪ੍ਰਭੂ ਦਾ ਕੀਰਤਨ ਕਰਦੇ ਹੈ ਜਿਸ 'ਚ ਕੋਈ ਅਰਦਾਸ ਕਰਦਾ ਹੈ ਕੋਈ ਭਜਨ ਕੀਰਤਨ ਕੋਈ ਗੀਤ ਕਵਾਲੀ ਅਲੱਗ ਅਲੱਗ ਤਰ੍ਹਾਂ ਦੇ ਹੁੰਦੇ ਹੈ ਜਿਵੇਂ ਆਪਾਂ ਕਹੀਏ ਵੀ ਅਗਰ ਉਹ ਜਿਹੜੇ ਧਾਰਮਿਕ ਸਥਾਨਾਂ ਦੇ ਜਿਹੜੇ ਭਜਨ ਕੀਰਤਨ ਹਰੇਕ ਸਥਾਨ 'ਤੇ ਹੀ ਉਹ ਕੀਤੇ ਜਾਂਦੇ ਹੈ ਚਰਚ ਦੇ ਵਿੱਚ ਜਾਓ ਤਾਂ ਉੱਥੇ ਪ੍ਰਾਰਥਨਾ ਕੀਤੀ ਜਾਂਦੀ ਹੈ ਹਰੇਕ ਐਤਵਾਰ ਪ੍ਰਾਰਥਨਾ ਹੁੰਦੀ ਹੈ ਜਾਂ ਕੋਈ ਛੁੱਟੀ ਵਾਲਾ ਦਿਨ ਹੁੰਦਾ ਉਸ ਦਿਨ ਪ੍ਰਾਰਥਨਾ ਕਰ ਲੈਂਦੇ ਹੈ ਦਰਗਾਹ ਦੇ ਵਿੱਚ ਨੋਰਮਲੀ ਅਸੀਂ ਜਾਈਏ ਤਾਂ ਉੱਥੇ ਕਵਾਲੀਆਂ ਚੱਲਦੀਆਂ ਕਵਾਲੀਆਂ ਦੇ ਨਾਲ ਨਾਲ ਹੀ ਪੂਜਾ ਪਾਠ ਜਿਹੜੀ ਉਹਨਾਂ ਦੀ ਆਪਣੇ ਤਰੀਕੇ ਦੀ ਹੁੰਦੀ ਉਹ ਕਰਦੇ ਹੈ ਮਸਜਿਦ ਵਿੱਚ ਚਲੇ ਜਾਓ ਉੱਥੇ ਜਿਹੜੇ ਸਾਰੇ ਇਕੱਠੇ ਮਿਲ ਕੇ ਇੱਕ ਠੇ ਕਰਦੇ ਹੈ ਵਜ਼ੂ ਕਰਦੇ ਹੈ ਗੁਰਦੁਆਰੇ ਚਲੇ ਜਾਓ ਤਾਂ ਉੱਥੇ ਕੀਰਤਨ ਹੁੰਦਾ ਕੀਰਤਨ ਤੋਂ ਬਾਅਦ ਪ੍ਰਸ਼ਾਦ ਵੰਡਿਆ ਜਾਂਦਾ ਅਤੇ ਮੱਠ ਵਗੈਰਾ ਚਲੇ ਜਾਓ ਉੱਥੇ ਸਤਸੰਗ ਹੁੰਦੀ ਹੈ ਇਕੱਠੇ ਹੋ ਕੇ ਸਾਰੇ ਅ ਭਾਵ ਸਿਰਫ਼ ਇੱਕੋ ਹੀ ਹੁੰਦਾ ਕਿ ਪ੍ਰਭੂ ਦਾ ਜਸ਼ੋਗਾਣ ਕੀਤਾ ਜਾ ਸਕੇ ਅਤੇ ਜਿਹੜੀ ਮੰਨ ਦੀ ਜਿਹੜੀ ਸ਼ਾਂਤੀ ਦੀ ਅਵਸਥਾ ਬਣੀ ਰਹੇ ਅਤੇ ਅਲੱਗ ਅਲੱਗ ਸਥਾਨਾਂ ਦਾ ਜਿਹੜਾ ਅਲੱਗ ਅਲੱਗ ਆਪਣਾ ਆਪਣਾ ਤਰੀਕਾ ਹੋਇਆ ਕਰਦਾ ਹੈ ਪ੍ਰਭੂ ਦੇ ਪੂਜਣ ਦਾ ਪਰ ਸਭ ਦੇ ਤਰੀਕੇ ਜਿਹੜੇ ਹੈ ਉਹ ਸਭ ਪ੍ਰਵਾਨ ਹੈ ਪ੍ਰਭੂ ਨੂੰ ਤਾਂ ਸ਼ਰਧਾ ਅਤੇ ਭਾਵਨਾ ਦੇ ਨਾਲ ਜਿਹੜਾ ਜਿਸ ਤਰ੍ਹਾਂ ਪੂਜ ਲਵੇ ਇਹ ਉਹਦੀ ਦਰਗਾਹ 'ਤੇ ਵੀ ਪ੍ਰਵਾਨ ਹੋ ਜਾਂਦਾ